ਅਸੀਂ ਬਹੁਤ ਸਾਰੇ ਸੱਭਿਆਚਾਰੀ ਤਿਉਹਾਰ ਅਤੇ ਸਮਾਗਮ ਮਨਾਉਂਦੇ ਹਨ ਬਹੁਤ ਜਿਵੇਂ ਕਿ ਦਿਵਾਲੀ ਦੁਸ਼ਹਿਰਾ ਲੋਹੜੀ ਵਿਸਾਖੀ ਦਾ ਮੇਲਾ ਜਿਹੜਾ ਵੀ ਤਿਉਹਾਰ ਆਉਂਦਾ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਨਹੀਂ ਅੱਜ ਕੱਲ ਪਹਿਲਾਂ ਪੁਰਾਣੇ ਜ਼ਮਾਨੇ 'ਚ ਸੀ ਕਿ ਸਿਰਫ ਮੁੰਡਿਆਂ ਦੀ ਲੋਹੜੀ ਪਾਉਂਦੇ ਸੀ ਪਰ ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਏ ਅਤੇ ਹੁਣ ਕੁੜੀਆਂ ਦੀ ਵੀ ਲੋਹੜੀ ਓਨੇ ਹੀ ਚਾਵਾਂ ਨਾਲ ਮਨਾਈ ਜਾਂਦੀ ਜਿੰਨੀ ਚਾਵਾਂ ਨਾਲ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਅਤੇ ਜਿਸ ਕਰ ਕੋਈ ਵੀ ਨਵ ਨਵਾਂ ਬੱਚਾ ਜੰਮਦਾ ਤਾਂ ਉੱਥੇ ਉਹ ਖੁਸ਼ੀ ਨਾਲ ਨਿਆਣਿਆਂ ਨੂੰ ਲੋਹੜੀ ਦਿੰਦੇ ਹੈ ਅਤੇ ਘਰ ਵਿੱਚ ਲੋਹੜੀ ਬਾਲ਼ ਕੇ ਗਿੱਧਾ ਭੰਗੜਾ ਪਾਉਂਦੇ ਆ ਬੜੇ ਧੂਮ ਧਾਮ ਨਾਲ ਲੋਹੜੀ ਮਨਾਈ ਜਾਂਦੀ ਹੈ ਇਸੇ ਤਰ੍ਹਾਂ ਜਿਹੜੀ ਦਿਵਾਲੀ ਹੈ ਉਹ ਵੀ ਲੋਕੀ ਪਹਿਲਾਂ ਹੀ ਦਿਵਾਲੀ ਤੋਂ ਪਹਿਲਾਂ ਹੀ ਦਿਵਾਲੀ ਦੀ ਤਿਆਰੀ ਕਰਨਾ ਸ਼ੁਰੂ ਕਰ ਦਿੰਦੇ ਅਤੇ ਦਿਵਾਲੀ ਵਾਲੇ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਪਟਾਕੇ ਬਾ ਪਟਾਕੇ ਚਲਾਉਂਦੇ ਬੜੇ ਧੂਮ ਧਾਮ ਨਾਲ ਦਿਵਾਲੀ ਮਨਾਈ ਜਾਂਦੀ ਜਿਹੜਾ ਵਿਸਾਖੀ ਦਾ ਮੇਲਾ ਏ ਵਿਸਾਖੀ ਦੇ ਮੇਲੇ ਨੂੰ ਵੀ ਜਿਹੜੇ ਕਿਸਾਨ ਇਹਨਾਂ ਦੀਆਂ ਫਸਲਾਂ ਜਦੋਂ ਪੱਕ ਜਾਂਦੀਆਂ ਇਹ ਵੀ ਬੜੇ ਧੂਮ ਧਾਮ ਨਾਲ ਖੁਸ਼ੀ ਨਾਲ ਵਿਸਾਖੀ ਦੇ ਮੇਲੇ ਨੂੰ ਮਨਾਉਂਦੇ ਆ ਅਤੇ ਦੁਸ਼ਹਿਰੇ ਦਾ ਦੁਸ਼ਹਿਰੇ ਦਾ ਮੇਲਾ ਵੀ ਅਲੱਗ ਥਾਂ ਅਲੱਗ ਅਲੱਗ ਥਾਵਾਂ 'ਤੇ ਲੱਗਦਾ ਏ ਅਤੇ ਲੋਕੀਂ ਦੁਸਹਿ ਜਦੋਂ ਰਾਵਣ ਦੇ ਪੁਤਲਿਆਂ ਨੂੰ ਸਾੜਦਾ ਦੇਖਣ ਜਾਂਦੀ ਹੈ ਅਤੇ ਉੱਥੇ ਝੂਲੇ ਅਲੱਗ ਅਲੱਗ ਤਰ੍ਹਾਂ ਦੇ ਝੂਲੇ ਲੱਗੇ ਹੁੰਦੇ ਝੂਲੇ ਝੂਟਦੇ ਜਿਹੜ ਬੱਚੇ ਹੈ ਇਹਨਾ ਇਹਨਾ ਮੇਲਿਆਂ ਦਾ ਬਹੁਤ ਆਨੰਦ ਉਠਾਉਂਦੇ ਆ ਅਤੇ ਜਿਹੜੇ ਇਹ ਤਿਉਹਾਰ ਹੈ ਸਾਰੇ ਇਹ ਭਾਈਚਾਰੇ ਅਤੇ ਪਿਆਰ ਨੂੰ ਪ੍ਰਗਟ ਕਰਦੇ ਅਤੇ ਇਹ ਵਧੀਆ ਢੰਗ ਨਾਲ ਐਨ ਮਨਾਏ ਜਾਂਦੇ ਆ ਅਤੇ ਅਸੀਂ ਤਿਉਹਾਰ ਵਾਲੇ ਦਿਨ ਭਿੰਨ ਭਿੰਨ ਤਰ੍ਹਾਂ ਦੇ ਪਕਵਾਨ ਪਕਾਉਂਦੇ ਹਨ ਅਤੇ ਲੋਹੜੀ ਵੇਲੇ ਜ ਜਦੋਂ ਨਿਆਣੇ ਲੋਹੜੀ ਲੋਹੜੀ ਮੰਗਣ ਆਉਂਦੇ ਉਹਨਾਂ ਨੂੰ ਲੋਹੜੀ ਦਿੱਤੀ ਜਾਂਦੀ ਹੈ ਅਤੇ ਦਿਵਾਲੀ ਦੇ ਤਿਉਹਾਰ ਦਿਵਾਲੀ 'ਤੇ ਭਿੰਨ ਭਿੰਨ ਤਰ੍ਹਾਂ ਦੇ ਪਕਵਾਨ ਪਕਾ ਕੇ ਰਿਸ਼ ਆਪਣੇ ਗੁਆਂਡੀਆਂ ਜਾਂ ਰਿਸ਼ਤੇਦਾਰਾਂ ਨੂੰ ਦਿੱਤੇ ਜਾਂਦੇ ਹਨ